ਜੇਕਰ ਆਪਾਂ ਪਿੰਡ ਦੀ ਗੱਲ ਕਰੀਏ ਤਾਂ ਪਿੰਡ ਵਿੱਚ ਡਰੇਨ ਸਿਸਟਮ ਕੋਈ ਚੰਗਾ ਨਹੀਂ ਹੈ ਬਹੁਤਾ ਕਿਉੰਕਿ ਪਾਣੀ ਤਾਂ ਸੜਕਾਂ 'ਤੇ ਹੀ ਘੁੰਮ ਰਿਹਾ ਹੈ ਡਰੇਨ ਤਾਂ ਇਹਨਾਂ ਨੇ ਕਰਿਆ ਹੈ ਪਰ ਓਹ ਚੱਲ ਹੀ ਨਹੀਂ ਰਿਹਾ ਬਲੋਕਜ ਇੰਨੀ ਆ ਪਾਣੀ ਸੜਕਾਂ 'ਤੇ ਖੜ੍ਹ ਜਾਂਦਾ ਹੈ ਬਰਾਸ ਬਰਸਾਤ ਦੇ ਦਿਨਾਂ 'ਚ ਤਾਂ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ ਜਦੋਂ ਫਿਰ ਸੜਕਾਂ 'ਤੇ ਪਾਣੀ ਖੜ੍ਹਦਾ ਹੈ ਤਾਂ ਪਾਣੀ ਖੜ੍ਹਨ ਦੇ ਨਾਲ ਮੱਛਰ ਵਗੈਰਾ ਜਾਂ ਹੋਰ ਕਈ ਤਰਾਂ ਦੀ ਬਿਮਾਰੀਆਂ ਵੀ ਲੱਗ ਜਾਂਦੀਆਂ ਹਨ ਜਿਹਦਾ ਜ਼ਿਆਦਾ ਇਫ਼ੇਕਟ ਬੱਚਿਆ 'ਤੇ ਪੈਂਦਾ ਹੈ ਅਤੇ ਉਹਨਾਂ ਦਾ ਵਿਕਾਸ 'ਤੇ ਅਸਰ ਪੈਂਦਾ ਹੈ ਅਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਪਾਣੀ ਦੀ ਇੱਕ ਬਹ ਪਿੰਡਾਂ ਵਿੱਚ ਤਾਂ ਡਰੇਨ ਸਿਸਟਮ ਦੀ ਬਹੁਤ ਬੜੀ ਸਮੱਸਿਆ ਹੈ ਇਸ ਨੂੰ ਹੱਲ ਕਰਨ ਲਈ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਇਸ 'ਤੇ ਪਰੋਪਰ ਜਿਹੜੀ ਗਰਾਂਟ ਆ ਉਹ ਪੰਚਾਇਤ ਨੂੰ ਦੇਵੇ ਅਤੇ ਗਰਾਂਟ ਦੇ ਕੇ ਪੂਰਾ ਦੇਖੇ ਵੀ ਉਹ ਕੰਮ ਕਰਾ ਰਹੇ ਆ ਜਾਂ ਨਹੀਂ ਕਰਾ ਰਹੇ ਕੋਈ ਪ੍ਰੋਪਰ ਇੱਕ ਜਗ੍ਹਾ ਦੇਵੇ ਵੀ ਹਾਂ ਤੁਸੀ ਇਹ ਸਾਰਾ ਪਾਣੀ ਡਰੇਨ ਕਰਕੇ ਇੱਥੇ ਹੀ ਪਹੁੰਚਾਉਣਾ ਏ ਅਤੇ ਇਸ ਨੂੰ ਪਾਰਦਰਸ਼ੀ ਢੰਗ ਨਾਲ ਕਰਨਾ ਚਾਹੀਦਾ ਹੈ ਤਾਂ ਹੀ ਹੋ ਸਕਦਾ ਹੈ